ਹੈਲੋ ਯੈੱਸ ਸਤਿ ਸ਼੍ਰੀ ਅਕਾਲ ਜੀ ਹਾਂਜੀ ਹਾਂਜੀ ਬਿਲਕੁਲ ਹਾਂਜੀ ਦੱਸੋ ਤੁਹਾਡੀ ਕੀ ਹੈਲਪ ਕਰ ਸਕਦੇ ਹਾਂ ਹਾਂਜੀ ਪੁੱਛੋ ਹਾਂਜੀ ਹਾਂਜੀ ਪੰਜਾਬ ਕਲਚਰ ਨਾਲ਼ ਰਿਲੇਟਿਡ ਬਹੁਤ ਸਾਰੀਆਂ ਬੁੱਕਸ ਨੇ ਲਿਟਰੇਚਰ ਨਾਲ਼ ਰਿਲੇਟਿਡ ਪੰਜਾਬੀ 'ਚ ਬਹੁਤ ਸਾਰੀਆਂ ਬੁੱਕਸ ਨੇ ਤੁਸੀਂ ਦੱਸੋ ਤੁਸੀਂ ਕਿਹੜੀ ਬੁੱਕ ਅਤੇ ਕਿਹੜੇ ਰਾਈਟਰ ਦੀ ਲੈਣਾ ਚਾਹੁੰਦੇ ਹੋ ਹਾਂਜੀ ਹਾਂਜੀ ਹਾਂਜੀ ਬਲਵੰਤ ਗਾਰ ਗਾਰਗੀ ਉਹਨਾਂ ਜੀ ਦੇ ਨਾਟਕ ਹੈਗੇ ਨੇ ਸਾਡੇ ਕੋਲ ਸਾਡੇ ਕੋਲ ਸੋਹਨ ਸਿੰਘ ਸ਼ੀਤਲ ਦੀਆਂ ਬੁੱਕਸ ਹੈਗੀਆਂ ਨੇ ਹਾਂਜੀ ਹ ਹਾਂਜੀ ਹਾਂਜੀ ਕੰਮਪੀਟੀਟਿਵ ਐਗਜ਼ਾਮ ਦੀਆਂ ਬੁੱਕਸ ਹੈਗੀਆਂ ਜਿਹਦੇ ਵਿੱਚ ਤੁਹਾਨੂੰ ਜਨਰਲ ਨੌਲੇਜ਼ ਪੰਜਾਬ ਪੰਜਾਬ ਦੀ ਨੌਲੇਜ਼ ਬਾਰੇ ਕੰਮਪੀਟੀਟਿਵ ਐਗਜ਼ਾਮ ਦੇ ਬਾਰੇ ਜਿਵੇਂ ਰੀਜਨਿੰਗ ਹੋ ਗਈ ਇੰਗ ਜਰਨਲ ਇੰਗਲਿਸ਼ ਹੋ ਗਈ ਪੰਜਾਬ ਜੀਕੇ ਹੋ ਗਈ ਆਲ਼ ਓਵਰ ਵੱਲਡ ਦੀ ਹਿਸਟਰੀ ਹੋ ਗਈ ਉਹ ਸਾਰੀਆਂ ਮਿਲ ਜਾਣਗੀਆਂ ਹਾਂਜੀ ਉਹਦੇ ਰੀਲੇਟਿਡ ਵੀ ਤੁਹਾਨੂੰ ਬੁੱਕਸ ਈਸ਼ੂ ਹੋ ਜਾਣਗੀਆਂ ਬਟ ਉਹਦੇ ਲਈ ਤੁਹਾਨੂੰ ਪਹਿਲਾਂ ਆਪਣਾ ਕਾਰਡ ਬਣਵਾਉਣਾ ਪਵੇਗਾ ਲਾਇਬ੍ਰੇਰੀ ਜਾ ਕੇ ਉਹਦੇ ਲਈ ਤੁਹਾਨੂੰ ਆਪਣਾ ਇੱਕ ਅਧਾਰ ਕਾਰਡ ਚਾਹੀਦਾ ਤੁਹਾਨੂੰ ਇੱਕ ਫੋਟੋ ਚਾਹੀਦੀ ਹੈ ਉਹ ਤੁਸੀਂ ਲੈ ਕੇ ਆ ਜਾਓ ਅਤੇ ਉਹਦੇ ਨਾਲ਼ ਤਿੰਨ ਹਜ਼ਾਰ ਰੁਪਇਆ ਫ਼ੀਸ ਹਾਂਜੀ ਹਾਂਜੀ ਤਿੰਨ ਹਜ਼ਾਰ ਰੁਪਇਆ ਫ਼ੀਸ ਹੈ ਜਿਹੜੀ ਕਿ ਛੇ ਮਹੀਨੇ ਦੀ ਹੁੰਦੀ ਹੈ ਛੇ ਮਹੀਨੇ ਤੱਕ ਮਤਲਬ ਤੁਸੀਂ ਤਿੰਨ ਹਜ਼ਾਰ ਰੁਪਇਆ ਦੇ ਕੇ ਇੱਥੇ ਇੱਥੇ ਵੀ ਪੜ੍ਹ ਸਕਦੇ ਹੋ ਅਤੇ ਬੁੱਕਸ ਵੀ ਈਸ਼ੂ ਕਰਵਾ ਸਕਦੇ ਹੋ ਘਰ ਲਈ ਸਾਡੀ ਲਾਇ ਸਾਡੀ ਲਾਇਬ੍ਰੇਰੀ ਸੱਤ ਵਜੇ ਤੋਂ ਲੈ ਕੇ ਸ਼ਾਮ ਸ਼ਾਮ ਦੇ ਦਸ ਵਜੇ ਤੱਕ ਖੁੱਲ੍ਹੀ ਹੁੰਦੀ ਹੈ ਹਾਂਜੀ ਹਾਂਜੀ ਅਗਰ ਅਸੀਂ ਨਾ ਹੋਏ ਸਾਡੇ ਸਟਾਫ ਦਾ ਕੋਈ ਵੀ ਮੈਂਬਰ ਇੱਥੇ ਜ਼ਰੂਰ ਅਵੇਲੇਵਲ ਹੁੰਦਾ ਹੈ ਕਿਸੇ ਵੀ ਟਾਈਮ ਤੁਸੀਂ ਆ ਸਕਦੇ ਹੋ ਹਾਂਜੀ ਇੱਥੇ ਹਰੇਕ ਲੈਂਗੂਏਜ਼ ਦੇ ਵਿੱਚ ਬੁੱਕ ਹੈ ਤੁਸੀਂ ਜਿਸ 'ਚ ਤੁਹਾਡਾ ਇੰਨਟਰਸਟ ਹੋਇਆ ਤੁਸੀਂ ਉਹ ਬੁੱਕ ਬਾ ਇਸ਼ੂ ਕਰਵਾ ਸਕਦੇ ਹੋ ਓਕੇ ਓਕੇ ਓਕੇ ਮੋਸਟ ਵੈਲਕਮ ਓਕੇ